ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਮਾਨਵ ਸਿੰਘ ਹੈ ਮੈਂ ਪਠਾਨਕੋਟ ਦਾ ਰਹਿਣ ਵਾਲਾ ਹਾਂ ਜਿੱਦਾਂ ਕਿ ਇਹਨਾਂ ਦਾ ਪ੍ਰਸ਼ਨ ਹੈ ਕਿ ਇਸ ਸਮੇਂ ਤੁਹਾਡੇ ਮਨ ਪਸੰਦ ਤਕਨੀਕੀ ਉਤਪਾਦ ਜਾਂ ਪਲੇਟਫਾਰਮ ਕੀ ਹਨ ਅਗਰ ਮੈਂ ਇਸ ਜਵਾਬ ਦੇਵਾਂਗਾ ਅਤੇ ਮੇਰਾ ਇਹ ਜਵਾਬ ਹੈ ਕਿ ਜਿੱਦਾਂ ਕਿ ਅੱਜ ਕੱਲ੍ਹ ਏ ਆਈ ਬਹੁਤ ਹੀ ਪ੍ਰਚਲਿਤ ਜਾਂ ਡਿਮਾਡਨਿੰਗ ਵਿੱਚ ਹੈ ਉਸ ਨੇ ਕਾਫ਼ੀ ਸਾਰੇ ਕੰਮ ਅੱਜ ਦੇ ਟਾਈਮ ਵਿੱਚ ਬਹੁਤ ਈਜ਼ੀ ਕਰ ਦਿੱਤੇ ਹਨ ਅਤੇ ਮੈਨੂੰ ਏ ਆਈ ਦਾ ਯੂਜ ਕਰਨਾ ਬਹੁਤ ਵਧੀਆ ਲੱਗਦਾ ਹੈ ਏ ਆਈ ਦੀ ਇਗਜਾਮਪਲ ਜਿੱਦਾਂ ਸਾਡੀ ਜੋ ਕਿ ਸਾਡੇ ਕੰਮ ਨੂੰ ਬਹੁਤ ਹੀ ਇਜਿਲੀ ਕਰ ਦਿੰਦੇ ਹਨ ਏ ਆਈ ਦੇ ਕਾਫ਼ੀ ਟੂਲ ਹਨ ਅਸੈਕਟਰਾ